ਆਰਥਿਕ ਖ਼ਬਰਾਂ ਬਾਰੇ ਜਾਣੂ ਰਹਿਣ ਲਈ ਕਾਰੋਬਾਰ ਵਿੱਤ ਅਤੇ ਵਿਸ਼ਵ ਅਰਥਸ਼ਾਸਤਰ ਵਿੱਚ ਮਾਹਰ ਨਾਮਵਰ ਸਰੋਤਾਂ ਦੀ ਪਾਲਣਾ ਕਰਨਾ ਮਹੱਤਵਪੂਰਨ ਹੈ ਇਹ ਆ ਆਊਟਲੈੱਟ ਬ ਬਜ਼ਾਰ ਦੇ ਰੁਝਾਨਾਂ ਆਰਥਿਕ ਨੀਤੀਆਂ ਕਾਰਪੋਰੇਟ ਵਿਕਾਸ ਅਤੇ ਵਿਸ਼ੇਸ਼ ਵਿੱਤੀ ਖਬਰਾਂ 'ਤੇ ਕੇਂਦਰਿਤ ਕਰਦੇ ਹਨ ਵਾਲ ਸਟਰੀਟ ਜਰਨਲ ਵਿਸ਼ਵ ਪੱਧਰ ਦੀ ਕਾਰੋਬਾਰ ਅਤੇ ਆਰਥਿਕ ਖ਼ਬਰਾਂ ਲਈ ਸਭ ਤੋਂ ਵੱਧ ਮਾਨਤਾ ਪ੍ਰਾਪਤ ਸਰੋਤਾਂ ਵਿੱਚੋਂ ਇੱਕ ਹੈ ਇਹ ਵਿੱਤੀ ਬਜ਼ਾਰਾਂ ਕਾਰਪੋਰੇਟ ਅਖ਼ਬਾਰਾਂ ਅਤੇ ਆਰਥਿਕ ਰੁਝਾਨਾਂ ਨੂੰ ਕਵਰ ਕਰਦਾ ਹੈ ਇੱਕ ਯੂਕੇ ਆਧਾਰ ਅਖ਼ਬਾਰ ਜੋ ਵਿਸ਼ਵ ਵਿੱਤ ਅਰਥਸ਼ਾਸਤਰ ਅਤੇ ਕਾਰੋਬਾਰ ਦੀ ਢੂੰਘਾਈ ਨਾਲ ਕਵਰੇਜ ਲਈ ਬਹੁਤ ਮਸ਼ਹੂਰ ਹੈ ਇਸ ਦਾ ਇੱਕ ਮਜ਼ਬੂਤ ਅੰਤਰਰਾਸ਼ਟਰੀ ਫੋਕਸ ਹੈ